ਮੈਂ ਮੀਟਿੰਗ ਵਿੱਚ ਸ਼ਾਮਿਲ ਹੋਣ ਲਈ ਬਹੁਤ ਸਾਰੀਆਂ ਡਿਫਰੈਂਟ ਐਪਸ ਵੀਡੀਓ ਕੋਨਫ੍ਰੈਂਸਿੰਗ ਐਪਸ ਦੀ ਵਰਤੋਂ ਕੀਤੀ ਹੈ ਜਿਵੇਂ ਜ਼ੂਮ ਗੂਗਲ ਮੀਟ ਸਭ ਤੋਂ ਜ਼ਿਆਦਾ ਤਾਂ ਜਿਸ ਤਰ੍ਹਾਂ ਮੈਂ ਐਜੂਕੇਸ਼ਨ ਫੀਲਡ 'ਚ ਹਾਂ ਤਾਂ ਮੈਂ ਗੂਗਲ ਮੀਟ ਦੀ ਬਹੁਤ ਜ਼ਿਆਦਾ ਵਰਤੋਂ ਕੀਤੀ ਹੈ ਮਾਈਕਰੋਸੋਫਟ ਟੀਮਜ ਵੀ ਹੈ ਪਰ ਗੂਗਲ ਮੀਟਸ ਮੈਨੂੰ ਸਭ ਤੋਂ ਵਧੀਆ ਲੱਗਦਾ ਹੈ ਕਿਉਂਕਿ ਗੂਗਲ ਮੀਟ ਦੇ ਥਰੂ ਆਪਾਂ ਬਹੁਤ ਸਾਰੇ ਲੋਕਾਂ ਨਾਲ ਵੀ ਜੁੜ ਸਕਦੇ ਹਾਂ ਅਤੇ ਗੂਗਲ ਮੀਟ ਬਸ ਮੈਨੂੰ ਉਹਦੀ ਇੱਕੋਂ ਹੀ ਗੱਲ ਨਾ ਪਸੰਦ ਲੱਗੀ ਹੈ ਕਿ ਉਹ ਜਦੋਂ ਜਿਹੜਾ ਮੋਬਾਈਲ ਐਪ 'ਤੇ ਜੋ ਚੱਲਦਾ ਹੈ ਗੂਗਲ ਮੀਟ ਉਹ ਉੰਨਾ ਵਧੀਆ ਨਹੀਂ ਹੈ ਜੋ ਲੈਪਟੋਪ 'ਤੇ ਚਲਦਾ ਹੈ ਕਿਉਂਕਿ ਲੈਪਟੋਪ 'ਤੇ ਸਾਨੂੰ ਸਾਰੇ ਬੰਦੇ ਪ੍ਰੋਪਰ ਦਿਖਦੇ ਹੈ ਪਰ ਜੇ ਅਸੀਂ ਮੋਬਾਈਲ 'ਤੇ ਦੇਖੀਏ ਤਾਂ ਮੋਬਾਈਲ 'ਤੇ ਰਾਈਟ 'ਤੇ ਸਵਾਈਪ ਕਰਕੇ ਫਿਰ ਦਿਖਦੇ ਹੈ ਅਤੇ ਉਹ ਵੀ ਬਹੁਤ ਸਾਰੇ ਘੱਟ ਲੋਕ ਦਿਖਦੇ ਹੈ ਪਰ ਸਾਨੂੰ ਨੰਬਰ ਓਫ ਪਾਰਟੀਸੀਪੈਂਟਸ ਤੋਂ ਹੀ ਪਤਾ ਲੱਗਦਾ ਹੈ ਕੀ ਕਿੰਨੇ ਲੋਕ ਹੈ ਪਰ ਅਗਰ ਅਵਾਜ਼ ਦੀ ਗੱਲ ਕਰੀਏ ਜਾਂ ਵੀਡੀਓ ਦੀ ਗੱਲ ਕਰੀਏ ਤਾਂ ਬੜੀ ਕਲੀਅਰ ਆਉਂਦੀ ਹੈ ਜੇ ਤੁਹਾਡਾ ਨੈੱਟ ਵਧੀਆ ਚਲਦਾ ਹੈ ਤਾਂ ਐਪ ਬੜੀ ਵਧੀਆ ਚਲਦੀ ਹੈ ਗੂਗਲ ਮੀਟ ਐਜੂਕੇਸ਼ਨ ਅਗਰ ਗੂਗਲ ਨੇ ਹੋਰ ਵੀ ਚੀਜਾਂ ਲੋਂਚ ਕੀਤੀਆਂ ਜੋ ਗੂਗਲ ਮੀਟ ਦੀ ਸਹਾਇਤਾ ਕਰਦੇ ਹੈ ਜਿਵੇਂ ਅਸੀਂ ਗੂਗਲ ਕਲਾਸਰੂਮ ਵਰਤ ਸਕਦੇ ਹਾਂ ਜਿਸ ਦੇ ਥਰੂ ਅਸੀਂ ਨੋਟ ਬਦਲ ਸਕਦੇ ਗੂਗਲ ਮੀਟ ਅਸੀਂ ਸਕਰੀਨ ਵੀ ਸ਼ੇਅਰ ਕਰ ਕੇ ਲੋਕਾਂ ਨੂੰ ਆਪਣਾ ਪ੍ਰਜੈਂਟ ਕਰ ਸਕਦੇ ਹਾਂ ਜੇ ਅਸੀਂ ਕੋਈ ਨੋਟ ਵੀ ਭੇਜਣਾ ਹੈ ਅਸੀਂ ਗੂਗਲ ਮੀਟ ਦੇ ਥਰੂ ਭੇਜ ਸਕਦੇ ਹੈਂ ਜੋ ਜ਼ੂਮ ਦੀ ਅਗਰ ਗੱਲ ਕਰੀਏ ਤਾਂ ਜ਼ੂਮ ਬੜੀ ਹਾਈ ਸਕੇਲ 'ਤੇ ਐਪ ਹੈ ਬੱਟ ਅਗੇਨ ਉਹਨੂੰ ਜੇ ਜ਼ਿਆਦਾ ਲੋਕਾਂ ਨੂੰ ਜੋੜਨਾ ਤਾਂ ਤੁਹਾਨੂੰ ਪੇ ਕਰਨਾ ਪਊਗਾ ਅਤੇ ਮਾਈਕਰੋਸੋਫਟ ਟੀਮ ਦਾ ਵੀ ਇਹ ਹੀ ਹੈ ਕਿ ਤੁਹਾਨੂੰ ਪੇ ਕਰਨਾ ਪਊਗਾ ਪਰ ਗੂਗਲ ਮੀਟ ਇੱਕ ਫ੍ਰੀ ਐਪ ਹੈ ਤਾਂ ਕਰਕੇ ਮੈਨੂੰ ਗੂਗਲ ਮੀਟ ਸਭ ਤੋਂ ਵਧੀਆ ਲੱਗਦੀ ਹੈ ਅਤੇ ਜਿਵੇਂ ਹੁਣ ਦੂਜੇ ਨੈੱਟਵਰਕਿੰਗ ਲਾਈਕ ਜਿਵੇਂ ਕਸ਼ਮੀਰ ਹੈ ਜਾਂ ਕੁਛ ਏਦਾਂ ਉਹਨੂੰ ਗੂਗਲ ਮੀਟ ਨੇ ਇੱਕ ਹੋਰ ਲੋਂਚ ਕੀਤੀ ਹੈ ਵਾਈਜ਼ ਐਪ ਜੋ ਸਾਨੂੰ ਬੜੀ ਸਹਾਇਤਾ ਮਿਲੀ ਜਿਹੜੇ ਲੋਅ ਨੈੱਟਵਰਕਿੰਗ ਏਰੀਆ ਵਾਲੇ ਖੇਤਰ ਨੇ ਥੈਂਕ ਯੂ